ਗਤਕਾ ਜੋ ਹੈ ਇਹ ਸਿੱਖ ਇਤਿਹਾਸ ਦਾ ਇੱਕ ਬਹੁਤ ਮਹੱਤਵਪੂਰਨ ਅੰਗ ਹੈ ਸਿੱਖ ਧਰਮ ਵਿੱਚ ਇਸ ਨੂੰ ਬਹੁਤ ਮੰਨਿਆ ਜਾਂਦਾ ਹੈ ਆਪਣੇ ਜੋ ਦਸ ਗੁਰੂ ਹੋਏ ਹਨ ਉਹਨਾਂ ਜਿੱਥੇ ਸ਼ਾਂਤੀ ਦੇ ਪ੍ਰਤੀਕ ਸਨ ਉੱਥੇ ਹੀ ਉਹਨਾਂ ਨੇ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਵੀ ਬਹੁਤ ਤਰ੍ਹਾਂ ਸਿੱਖਾਂ ਨੂੰ ਪ੍ਰੇਰਨਾ ਦਿੱਤੀਆਂ ਉਹਨਾਂ ਨੂੰ ਬਹੁਤ ਸਿੱਖਿਆ ਦਿੱਤੀ ਇਹਨਾਂ ਵਿੱਚੋਂ ਇੱਕ ਗਤਕਾ ਵੀ ਹੈ ਜਿਸ ਨੂੰ ਗੁਰੂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਸ਼ੁਰੂ ਕਰਿਆ ਸੀ ਉਹਨਾਂ ਨੇ ਇਸ ਨੂੰ ਆਪਣੀ ਆਤਮ ਰੱਖਿਆ ਵਾਸਤੇ ਸਿੱਖਣਾ ਬਹੁਤ ਜ਼ਰੂਰੀ ਕਰਿਆ ਸੀ ਇਹ ਸਿੱਖਾਂ ਦੀ ਉਸ ਟਾਈਮ ਦੀ ਸਭ ਤੋਂ ਜਰੂਰੀ ਸ਼ਿਕਸ਼ਾ ਸੀ ਇੱਕ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੂੰ ਬਾਕੀ ਹੋਰ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ ਇਹ ਸ਼ਸਤਰ ਵਿੱਦਿਆ ਦੇ ਅੰਦਰ ਗਤਕਾ ਵੀ ਸਿਖਾਇਆ ਜਾਂਦਾ ਸੀ ਜਿਸ ਨਾਲ ਉਹ ਆਪਣੇ ਉੱਤੇ ਹੋਣ ਵਾਲੇ ਜ਼ੁਲਮ ਨੂੰ ਤਾਂ ਰੋਕਦੇ ਹੀ ਸਨ ਅਤੇ ਹੋਰਾਂ 'ਤੇ ਵੀ ਹੋਣ ਵਾਲੇ ਜ਼ੁਲਮ ਨੂੰ ਰੋਕਦੇ ਸਨ ਇਸ ਨੂੰ ਉਹਨਾਂ ਨੇ ਸਿਰਫ ਆਤਮ ਰੱਖਿਆ ਵਾਸਤੇ ਅਤੇ ਹੋਰ ਆਪਣੇ ਰੱਖਿਆ ਦੂਜਿਆਂ ਦੀ ਰੱਖਿਆ ਕਰਨ ਵਾਸਤੇ ਸਿਖਾਇਆ ਸੀ ਸਾਨੂੰ ਜਿਸ ਦਾ ਉਹਨਾਂ ਨੂੰ ਅੱਗੇ ਚੱਲ ਕੇ ਜਿਵੇਂ ਮੁਗਲਾਂ ਦੀ ਫੌਜਾਂ ਨਾਲ ਵੀ ਲੜਨ ਵਾਸਤੇ ਇਹ ਬਹੁਤ ਕੰਮ ਆਇਆ ਅਤੇ ਆਪਣੀ ਫੌਜਾਂ ਨੂੰ ਉਹ ਹਰ ਇੱਕ ਨੂੰ ਗਤਕਾ ਸਭ ਤੋਂ ਪਹਿਲਾਂ ਸਿਖਾਉਂਦੇ ਸਨ ਜੋ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਬਣ ਗਿਆ ਸੀ ਅੱਜ ਇਹ ਇੱਕ ਤਰ੍ਹਾਂ ਦੀ ਹੂਟ ਜਿਸ ਤਰ੍ਹਾਂ ਦੀ ਖੇ ਖੇਡਾਂ ਨੇ ਉਸ ਤਰ੍ਹਾਂ ਗਤਕਾ ਵੀ ਇੱਕ ਤਰ੍ਹਾਂ ਦੀ ਖੇਡ ਹੈ ਜਿਸ ਵਿੱਚ ਬਹੁਤ ਤਰ੍ਹਾਂ ਦੇ ਮੁਕਾਬਲੇ ਹੁੰਦੇ ਹਨ ਹਰ ਜਗ੍ਹਾ ਇਸ ਨੂੰ ਬਹੁਤ ਵੱਧ ਚੜ੍ਹ ਕੇ ਲੋਕ ਹਿੱਸਾ ਲੈਂਦੇ ਹਨ ਔਰ ਹਿੰਦੁਸਤਾਨ ਕੀ ਬਾਹਰਲੇ ਜਿਹੜੇ ਜਿੱਥੇ ਸਿੱਖ ਨੇ ਉਹ ਵੀ ਇਸ ਨੂੰ ਸਿੱਖਦੇ ਵੀ ਹਨ ਅਤੇ ਇਸ ਦੇ ਬਾਰੇ ਜਾਣਕਾਰੀ ਵੀ ਲੈਂਦੇ ਹਨ ਅਤੇ ਉਸ ਨੂੰ ਪਸੰਦ ਵੀ ਬਹੁਤ ਕਰਦੇ ਹਨ